ਸਰਕਾਰ ਵੱਲੋਂ ਥਾਂ ਥਾਂ 'ਤੇ ਸਿਖਲਾਈ ਕੇਂਦਰ ਖੋਲ੍ਹੇ ਗਏ ਹਨ ਜਿਨਾਂ ਵਿੱਚ ਔਰਤਾਂ ਜਾ ਕੇ ਆਪਣਾ ਸਿਖਲਾਈ ਲੈਂਦੀਆਂ ਹਨ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ ਅਤੇ ਉਹ ਆਪਣਾ ਸਵੈ ਰੋਜ਼ਗਾਰ ਕਰਦੀਆਂ ਹਨ ਅਤੇ ਕੁਛ ਪਰਉਪਕਾਰੀ ਵੀ ਹੁੰਦੇ ਹਨ ਜਿਵੇਂ ਸੰਸਥਾਵਾਂ ਵਗੈਰਾ ਵੀ ਸਹਾਇਤਾ ਕਰਦੇ ਹਨ ਅਤੇ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਗਈਆਂ ਹਨ ਜਿਹੜੀਆਂ ਕਿ ਔਰਤਾਂ ਦੀ ਭਲਾਈ ਲਈ ਹਨ ਅਤੇ ਉਹ ਆਪਣੇ ਘਰ ਦਾ ਗੁਜ਼ਾਰਾ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਲੈਦੀਆਂ